ਮੈਂ ਪੰਜਾਬ ਸਟੇਟ ਦਾ ਰਹਿਣ ਵਾਲ਼ਾ ਹਾਂ ਸਾਡੇ ਸਟੇਟ ਦੇ ਵਿੱਚ ਬਹੁਤ ਹੀ ਚੰਗੀਆਂ ਚੀਜ਼ਾਂ ਹਨ ਕਿਤੇ ਕਿਤੇ ਗੁਰਦੁਆਰੇ ਬੜੇ ਬੜੇ ਉੱਥੇ ਤੀਰਥ ਯਾਤਰਾ ਵੀ ਘੁੰਮਣ ਲਈ ਜਾਂਦੇ ਹਾਂ ਕੋਈ ਐਸੀ ਦਿੱਕਤ ਨਹੀਂ ਆਉਂਦੀ ਜੀ ਬੜੇ ਲੰਗਰ ਵਗੈਰਾ ਵੀ ਚੱਲਦੇ ਹਨ ਫ੍ਰੀ ਸੇਵਾ ਵੀ ਕਰ ਪੰਜਾਬ ਸਟੇਟ ਬਹੁਤ ਅੱਛੀ ਸਟੇਟ ਹੈ ਜਿੱਥੇ ਕਿ ਲੰਗਰ ਦੀ ਸੇਵਾ ਆਮ ਫਰੀ ਕਰਦੇ ਹਨ ਕੋਈ ਦਿੱਕਤ ਸਾਨੂੰ ਨਹੀਂ ਆਉਂਦੀ ਪਰਿਵਾਰ ਨੂੰ ਲੈ ਕੇ ਵੀ ਅਸੀਂ ਇੱਥੇ ਘੁੰਮਦੇ ਫਿਰਦੇ ਰਹੇ ਬਾਕੀ ਸਟੇਟਾਂ ਨਾਲੋਂ ਸਾਡਾ ਪੰਜਾਬ ਸਟੇਟ 'ਚ ਬਹੁਤ ਵਧੀਆ ਸਿਸਟਮ ਠੀਕ ਹੈ ਜੀ ਬਾਕੀ ਤਾਂ ਮੈਂ ਦੇਖਿਆ ਇੱਧਰ ਉੱਧਰ ਘੁੰਮ ਕੇ ਕੋਈ ਐਸੀ ਸਹੂਲਤ ਨਹੀਂ ਮਿਲਦੀ ਹੈਗੀ ਜਿਹੜੀ ਪੰਜਾਬ ਦੇ ਅੰਦਰ ਸਾਨੂੰ ਬਹੁਤ ਵਧੀਆ ਵਧੀਆ ਚੀਜ਼ਾਂ ਦੇਖਣ ਨੂੰ ਅਤੇ ਸਹੂਲਤਾਂ ਵੀ ਬਹੁਤ ਉਹ ਸਾਨੂੰ ਫਾਇਦੇਮੰਦ ਹੈਗਾ ਜੀ ਬਹੁਤ ਸਹੂਲਤਾਂ ਕਾਫੀ ਪ ਪੰਜਾਬ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜੀ ਬਾਹਰੋਂ ਵੀ ਬੰਦਾ ਬਾਹਰ ਦੀਆਂ ਸਟੇਟਾਂ ਤੋਂ ਵੀ ਕੋਈ ਘੁੰਮਣ ਫਿਰਨ ਵੀ ਆਉਂਦਾ ਉਹਨਾਂ ਦੀ ਵੀ ਫਰੀ ਲੰਗਰ ਸੇਵਾ ਅਤੇ ਗੁਰਦੁਆਰਿਆਂ ਦੇ ਵਿੱਚ ਰਹਿਣ ਦੇ ਪ੍ਰਬੰਧ ਕੀਤੇ ਹੋਏ ਹਨ ਬਹੁਤ ਚੰਗਾ ਸਾਡਾ ਪੰਜਾਬ ਬਹੁਤ ਹੀ ਖੁਸ਼ਹਾਲ ਹੈ ਜੀ ਪੰਜਾਬ ਦੇ ਵਿੱਚ ਨਾ ਕੋਈ ਨਦੀਆਂ ਅਤੇ ਦੇ ਵਿੱਚ ਵੀ ਘੁੰਮਣ ਨੂੰ ਬਹੁਤ ਚੰਗੇ ਚੰਗੀਆਂ ਸਹੂਲਤਾਂ ਹੈਗੀਆਂ ਨੇ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਬਹੁਤ ਸਾਡਾ ਪੰਜਾਬ ਚੰਗਾ ਹੈ ਜੀ ਚੰ ਪੰਜਾਬ ਦੇ ਵਿੱਚ ਮੈਂ ਪੰਜਾਬ ਦਾ ਹੀ ਰਹਿੰਦਾ ਬਹੁਤ ਪਸੰਦ ਹੈ ਮੈਨੂੰ ਇੱਥੇ ਬਹੁਤ ਚੰਗੀਆਂ ਚੰਗੇ ਸਹੂਲਤਾਂ ਦੇ ਕੀਤੇ ਜਾਂਦੇ ਬੰਦੋਬਸਤ ਕੀਤੇ ਜਾਂਦੇ ਹਨ